ਸਾਡੇ ਘਰ ਵਿੱਚ ਇੱਕ ਛੋਟੀ ਜਿਹੀ ਬਗੀਚੀ ਹੈ ਜਿੱਥੇ ਅਸੀਂ ਪੰਛੀਆਂ ਦੇ ਖਾਣ ਲਈ ਅਨਾਜ ਅਤੇ ਪਾਣੀ ਰੱਖ ਦਿੰਦੇ ਹਾਂ ਮੈਨੂੰ ਲੱਗਦਾ ਹੈ ਕਿ ਪੰਛੀਆਂ ਨੂੰ ਆਕਰਸ਼ਿਤ ਕਰਨ ਲਈ ਇਹ ਬਹੁਤ ਹੀ ਜ਼ਿਆਦਾ ਵਧੀਆ ਸਾਧਨ ਹੈ ਕਿ ਅਸੀਂ ਪੰਛੀਆਂ ਲਈ ਕੁਝ ਖਾਣ ਲਈ ਅਨਾਜ ਅਤੇ ਪਾਣੀ ਰੱਖੀਏ